ਸਤਿ ਸ਼੍ਰੀ ਅਕਾਲ ਜੀ ਟਰਿਪ ਦੀ ਸਭ ਤੋਂ ਯਾਦਗਾਰੀ ਯਾਤਰਾ ਮੇਰੀ ਹੈਗੀ ਆ ਜਦੋਂ ਮੈਂ ਸਕੂਲ ਟਾਈਮ ਸੀ 'ਚ ਸੀਗੀ ਉਦੋਂ ਚਾਰ ਸਾਹਿਬਜ਼ਾਦੇ ਮੂਵੀ ਰਿਲੀਜ਼ ਹੋ ਗਈ ਸੀ ਅਤੇ ਉਦੋਂ ਸਾਨੂੰ ਉਹ ਦਿਖਾਉਣ ਲੈ ਕੇ ਗਏ ਸੀ ਉਹ 'ਚ ਕੀ ਸੀਗਾ ਕਿ ਜਦੋਂ ਮੈਂ ਉੱਥੇ ਜਾਣਾ ਸੀਗਾ ਮੈਂ ਬਹੁਤ ਐਕਸਾਈਟਡ ਸੀਗੀ ਫਿਰ ਕੀ ਸੀਗਾ ਮੈਂ ਪਹਿਲਾਂ ਤਾਂ ਖਾਣਾ ਬਣਾਇਆ ਅਤੇ ਮੈਂ ਬਹੁਤ ਐਕਸਾਈਟ ਸੀ ਮੈਂ ਪਾਸਤਾ ਲੈ ਕੇ ਗਈ ਸੀਗੀ ਆਪਣੇ ਫਰੈਂਡਸ ਨਾਲ ਬੈਠ ਕੇ ਅਤੇ ਪਹਿਲਾਂ ਤਾਂ ਮੂਵੀ ਦੇਖੀ ਫਿਰ ਜਦੋਂ ਮੂਵੀ ਦੇਖੀ ਉਹ ਮੂਵੀ ਬਹੁਤ ਪਿਆਰੀ ਮੂਵੀ ਸੀ ਚਾਰ ਸਾਹਿਬਜ਼ਾਦਿਆਂ ਦੀ ਜਿਹੜੀ ਮੂਵੀ ਸੀਗੀ ਨਾ ਉਹ ਏਕਤਾ ਦੱਸਦੀ ਹੈ ਕਿ ਤਾਂ ਮਤਲਬ ਭੈਣ ਭਰਾਵਾਂ 'ਚ ਪਿਆਰ ਸੀਗਾ ਉਸ ਤੋਂ ਬਾਅਦ ਕੀ ਸੀਗਾ ਕਿ ਮਤਲਬ ਮੂਵੀ 'ਚ ਬਹੁਤ ਜ਼ਿਆਦਾ ਕੀ ਕੁਰਬਾਨੀਆਂ ਕਿੰਨੀਆਂ ਦਿੱਤੀਆਂ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਚਾਰ ਸਾਹਿਬਜ਼ਾਦਿਆਂ ਨੇ ਕਿੰਨੀ ਕਿੰਨੇ ਕੁਰਬਾਨੀਆਂ ਦਿੱਤੀਆਂ ਆ ਸਾਡੇ ਵਾਸਤੇ ਉਹਨਾਂ ਨੇ ਕਿੰਨਾ ਕੁਛ ਕੀਤਾ ਆ ਉਸ ਤੋਂ ਬਾਅਦ ਫਿਰ ਜਦੋਂ ਉਹ ਮੂਵੀ ਖ਼ਤਮ ਹੋਈ ਫਿਰ ਆਪਾਂ ਆਪਣੇ ਦੋਸਤਾਂ ਨਾਲ ਬੈਠੇ ਖਾਣਾ ਖਾਧਾ ਅਤੇ ਫਿਰ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਸਕੂਲ ਟਰਿਪ ਵਾਪਸ ਆਈ ਉਸ ਤੋਂ ਬਾਅਦ ਫਿਰ ਟੀਚਰਸ ਨੂੰ ਆਪਣਾ ਐਕਸਪੀਰੀਅੰਸ ਦੱਸਿਆ ਸਾਰੀਆਂ ਗੱਲਾਂ ਬਾਤਾਂ ਹੋਈਆਂ ਅਤੇ ਜਿਹੜੇ ਉਹ ਦੋਸਤ ਸੀ ਨਾ ਕੋਲਸ ਸਕੂਲ ਟਾਈਮ ਵਾਲੇ ਉਹ ਨਹੀਂ ਭੁੱਲਦੇ ਉਹਨਾਂ ਦੀ ਯਾਦ ਅੱਜ ਵੀ ਆਉਂਦੀ ਆ ਧੰਨਵਾਦ